ਭਾਰਤੀ ਸਿਹਤ ਸੰਭਾਲ ਪ੍ਰਣਾਲੀ ਨਾ ਤਾਂ ਬਹੁਤ ਜ਼ਿਆਦਾ ਮਾੜੀ ਹੈ ਅਤੇ ਨਾ ਬਹੁਤ ਜ਼ਿਆਦਾ ਚੰਗੀ ਹੈ ਇਹ ਤਾਂ ਸਾਹਮਣਾ ਕਰਨ ਵਾਲਿਆਂ ਨੂੰ ਕਈ ਤਰ੍ਹਾਂ ਦੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਪਹਿਲੀ ਗੱਲ ਤਾਂ ਐਵੇਂ ਹੈ ਕਿ ਜਦੋਂ ਕੋਈ ਬੰਦਾ ਸਰਕਾਰੀ ਹੋਸਪੀਟਲ ਦੇ ਵਿੱਚ ਅਗਰ ਚਲਾ ਜਾਂਦਾ ਹੈ ਤਾਂ ਪਹਿਲਾਂ ਉਹਦੀ ਕੋਈ ਗੱਲ ਸੁਣਨ ਨੂੰ ਡਾਕਟਰ ਹੀ ਅਵੇਲੇਬਲ ਨਹੀਂ ਹੁੰਦਾ ਨਾ ਕੋਈ ਡਾਕਟਰ ਹੁੰਦਾ ਆ ਨਾ ਕੁਛ ਉਹਨੂੰ ਜਗ੍ਹਾ ਜਗ੍ਹਾ ਪਹਿਲਾਂ ਤਾਂ ਧੱਕੇ ਖਾਣੇ ਪੈਂਦੇ ਹੈ ਉਸ ਤੋਂ ਬਾਅਦ ਜਾ ਕੇ ਜਦੋਂ ਉਹਦੀ ਕੋਈ ਪਰਚੀ ਬਣਦੀ ਹੈ ਜਾਂ ਫੇਰ ਉਹ ਡਾਕਟਰ ਕੋਲ ਪਹੁੰਚਦਾ ਉੱਥੇ ਜਾ ਕੇ ਡਾਕਟਰ ਨਾ ਤਾਂ ਉਹਦੀ ਚੰਗੀ ਤਰ੍ਹਾਂ ਗੱਲ ਸੁਣਨਾ ਚਾਹੁੰਦੇ ਆ ਡਾਕਟਰ ਨੂੰ ਇਹ ਹੁੰਦਾ ਕਿ ਇਹ ਪ੍ਰਾਈਵੇਟ ਆਉਣ ਮੈਨੂੰ ਫੀਸ ਦੇਣ ਫੇਰ ਆਪਾਂ ਸੁਣਿਆ ਜਾਵੇ ਚਲੋ ਸਾਰੇ ਡਾਕਟਰ ਐਵੇਂ ਦੇ ਵੀ ਨਹੀਂ ਹੁੰਦੇ ਕੁਛ ਸੁਣਦੇ ਵੀ ਹੈਗੇ ਹੈ ਉਸ ਉਸ ਤੋਂ ਬਾਅਦ ਜਿਹੜੇ ਦਵਾ ਦਵਾਈਆਂ ਆ ਜੇ ਤਾਂ ਜਿਹਦੀ ਕਿ ਅੰਦਰ ਕਲੀਨਿਕ ਬਣਾਏ ਹੁੰਦੇ ਹੈ ਜਿਹੜੇ ਕਿ ਸਸਤੀ ਦਵਾਈ ਮਿਲ ਜਾਵੇਗੀ ਉੱਥੇ ਦਵਾਈਆਂ ਹੀ ਅਵੇਲੇਬਲ ਨਹੀਂ ਹੁੰਦੀਆਂ ਐਕਸਰੇ ਕਰਵਾਉਣ ਨੂੰ ਕਿਹਾ ਜਾਂਦਾ ਤਾਂ ਐਕਸਰੇ ਨਹੀਂ ਹੁੰਦੇ ਉੱਥੇ ਡਾਕਟਰ ਨਹੀਂ ਅਵੇਲੇਬਲ ਹੁੰਦੇ ਕਿਉਂਕਿ ਮੈਂ ਜਿੰਨਾ ਕੁ ਸੁਣਿਆ ਮੈਂ ਉਸਦੇ ਅਕੋਰਡਿੰਗ ਕਹਿ ਰਹੀ ਹਾਂ ਕਈ ਜਗ੍ਹਾ ਹੁੰਦੇ ਵੀ ਹੈਗੇ ਆ ਕਈ ਜਗ੍ਹਾ ਨਹੀਂ ਵੀ ਹੁੰਦੇ ਹੈਗੇ ਅਤੇ ਮਤਲਬ ਉਸ ਤੋਂ ਇਲਾਵਾ ਵੀ ਹੋਰ ਕਈ ਤਰ੍ਹਾਂ ਦੀਆਂ ਚੁਣੌਤੀਆਂ ਕਈ ਜਗ੍ਹਾ ਐਕਸਰੇ ਮਸ਼ੀਨ ਹੀ ਅਵੇਲੇਬਲ ਨਹੀਂ ਹੈ ਜਿੱਥੇ ਤੁਸੀਂ ਪਿੰਡਾਂ 'ਚ ਗੱਲ ਕਰ ਲਓ ਜਿੰਨੇ ਪਿੰਡ ਹੈ ਕੋਈ ਕਿਤੇ ਐਵੇਂ ਦਾ ਨਹੀਂ ਹੈ ਕਿ ਜਿੱਥੇ ਐਕਸਰੇ ਮਸ਼ੀਨ ਹੋਵੇ ਛੋਟਾ ਜਿਹਾ ਐਕਸਰੇ ਕਰਵਾਉਣ ਲਈ ਵੀ ਉਹਨਾਂ ਬੱ ਲੋਕਾਂ ਨੂੰ ਸ਼ਹਿਰ ਆਉਣਾ ਪੈਂਦਾ ਸ਼ਹਿਰ ਆ ਕੇ ਐਕਸਰੇ ਕਰਵਾਉਂਦੇ ਹੈ ਫੇਰ ਉਹਨਾਂ ਨੂੰ ਤ ਉੱਥੇ ਆ ਕੇ ਦਿਖਾਉਣਾ ਪੈਂਦਾ ਜਿਹੜੇ ਪਿੰਡਾਂ 'ਚ ਡਿਸਪੈਂਸਰੀਆਂ ਵਗੈਰਾ ਕੁਛ ਵੀ ਹੈ ਉੱਥੇ ਕਿਤੇ ਵੀ ਕੋਈ ਐਕਸਰੇ ਮਸ਼ੀਨ ਜਿਹੜੀ ਹੈ ਉਹ ਵੀ ਅਵੇਲੇਬਲ ਨਹੀਂ ਹੈ ਨਾ ਉੱਥੇ ਟੈਸਟ ਹੋ ਪਾਉਂਦੇ ਹੈ ਕੁਛ ਵੀ ਉੱਥੇ ਅਵੇਲੇਬਲ ਨਹੀਂ ਹੁੰਦਾ ਛੋਟੇ ਛੋਟੇ ਬਿਮਾਰੀਆਂ ਲਈ ਵੀ ਲੋਕਾਂ ਨੂੰ ਸ਼ਹਿਰ ਤੱਕ ਆਉਣਾ ਪੈਂਦਾ ਇਸ ਤੋਂ ਇਲਾਵਾ ਵੱਡੀਆਂ ਬਿਮਾਰੀਆਂ ਦੀ ਜੇਕਰ ਗੱਲ ਕਰ ਕਰੀਏ ਤਾਂ ਉਹਨਾਂ ਦਾ ਇਲਾਜ ਇੰਨਾ ਕੁ ਮਹਿੰਗਾ ਕਿ ਲੋਕ ਅਫੋਰਡ ਹੀ ਨਹੀਂ ਕਰ ਪਾਉਂਦੇ ਜਿਹੜੀ ਹੈਲਥ ਸਕੀਮਾਂ ਹੈ ਉਹਦੇ ਬਾਰੇ ਲੋਕਾਂ ਨੂੰ ਜਾਣਕਾਰੀ ਨਹੀਂ ਹੈਗੀ ਉਹ ਉੱਥੋਂ ਤੱਕ ਵੀ ਪਹੁੰਚ ਨਹੀਂ ਪਾਉਂਦੇ ਅਤੇ ਇਸ ਕਰਕੇ ਕਾਫੀ ਜ਼ਿਆਦਾ ਚੁਣੌਤੀਆਂ ਦਾ ਲੋਕਾਂ ਨੂੰ ਸਾਹਮਣਾ ਜਿਹੜਾ ਉਹ ਕਰਨਾ ਪੈਂਦਾ ਹੈ